ਭਾਰ ਵਧਾਉਣ ਦੇ ਕਾਫੀ ਸਾਰੇ ਘਰੇਲੂ ਉਪਚਾਰ ਹਨ ਜਿਵੇਂ ਕਿ ਜਿਹੜਾ ਜ਼ਿਆਦਾ ਹੀ ਕਮਜ਼ੋਰ ਵਿਅਕਤੀ ਹੁੰਦਾ ਹੈ ਉਸਨੂੰ ਭਾਰ ਵਧਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਉਸਦੇ ਸਰੀਰ ਦੀ ਸੁਰ ਸੁਰਕਸ਼ਾ ਲਈ ਉਸਦੇ ਸਰੀਰ ਦੀ ਸਿਹਤ ਤੰਦਰੁਸਤੀ ਲਈ ਉਸਨੂੰ ਭਾਰ ਵਧਾਉਣਾ ਬਹੁਤ ਹੀ ਜ਼ਰੂਰੀ ਹੈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਕਾਲੇ ਛੋਲੇ ਖਾਣ ਨਾਲ ਭਾਰ ਬਹੁਤ ਛੇਤੀ ਵੱਧ ਜਾਂਦਾ ਹੈ ਅਤੇ ਹਰੇਕ ਉਸ ਕਮਜ਼ੋਰ ਵਿਅਕਤੀ ਨੂੰ ਕਾਲੇ ਛੋਲੇ ਖਾਣੇ ਚਾਹੀਦੇ ਹਨ ਦੁੱਧ ਦੁੱਧ ਪੀਣਾ ਚਾਹੀਦਾ ਹੈ ਹਨ ਦੁੱਧ ਪੀਣਾ ਚਾਹੀਦਾ ਹੈ ਪ੍ਰੋਟੀਨ ਲੈਣਾ ਚਾਹੀਦਾ ਹੈ ਦਾਲਾਂ ਖਾਣੀਆਂ ਚਾਹੀਦੀਆਂ ਹਨ ਹਰੀਆ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ ਜਿਸ ਨਾਲ ਉਸ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਵਧੇ ਅਤੇ ਉਹ ਤੰਦਰੁਸਤ ਬਣਿਆ ਰਹੇ ਮੋਟਾਪਾ ਮੋਟਾਪਾ ਵੀ ਵੱਧ ਜਾਂਦਾ ਹੈ ਬਟ ਆਪਣਾ ਇੰਨਾਂ ਕੁ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਮੋਟਾਪਾ ਜ਼ਿਆਦਾ ਵੀ ਨਾ ਵਧੇ ਖੁਰਾਕ ਇੰਨੀ ਕੁ ਲਓ ਕਿ ਆਪਣਾ ਸਰੀਰ ਸਿਹਤ ਰਹੇ ਸਿਹਤਮੰਦ ਰਹੇ ਅਤੇ ਅਸੀਂ ਵੀ ਠੀਕ ਰਹੀਏ ਉਸਨੂੰ ਯੋਗਾ ਵੀ ਕਰਨਾ ਚਾਹੀਦਾ ਅਗਰ ਲੋੜ ਪਵੇ ਤਾਂ ਜਿੰਮ ਦੀ ਸਹਾਇਤਾ ਵੀ ਲੈਣੀ ਚਾਹੀਦੀ ਹੈ ਜਿੰਮ ਦੇ ਵਿੱਚ ਵੀ ਅਸੀਂ ਆਪਣਾ ਭਾਰ ਵਧਾ ਸਕਦੇ ਹਾਂ ਜ਼ਰੂਰੀ ਨਹੀਂ ਕਿ ਅਸੀਂ ਜਿੰਮ ਦੇ ਵਿੱਚ ਭਾਰ ਘਟਾਉਣ ਹੀ ਜਾਂਦੇ ਹਾਂ ਅਸੀਂ ਆਪਣਾ ਸਿਹਤ ਬਣਾਉਣ ਦੇ ਲਈ ਭਾ ਭਾਰ ਵਧਾ ਵੀ ਸਕਦੇ ਹਾਂ ਜਿਸ ਨਾਲ ਸਾਨੂੰ ਪ੍ਰੋਟੀਨ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ